ਸਾਡੇ ਖੇਤਰ ਵਿੱਚ ਦਸਵੀਂ ਤੋਂ ਬਾਅਦ ਬੱਚੇ ਜ਼ਿਆਦਾਤਰ ਜਿਹੜੇ ਬੱਚੇ ਤਾਂ ਅੱਸੀ ਤੋਂ ਨੰਬੇ ਪਚੰਨਵੇ ਪ੍ਰਸੈਂਟ ਵਿੱਚ ਹੁੰਦੇ ਹਨ ਉਹ ਮੈਡੀਕਲ ਨੌਨ ਮੈਡੀਕਲ ਵਿੱਚ ਜਾਂਦੇ ਹਨ ਅਤੇ ਜਿਹੜੇ ਬੱਚੇ ਸੱਤਰ ਤੋਂ ਅੱਸੀ ਪ੍ਰਸੈਂਟ ਵਿੱਚ ਨੰਬਰ ਲੈਂਦੇ ਹਨ ਉਹ ਕਾਮਰਸ ਵਿੱਚ ਚਲੇ ਜਾਂਦੇ ਹਨ ਅਤੇ ਜਿਹੜੇ ਸੱਠ ਤੋਂ ਲੈ ਕੇ ਪੈਹੰਠ ਪ੍ਰਸੈਂਟ ਸੱਤਰ ਪ੍ਰਸੈਂਟ ਜਾਂ ਪੰਜਾਹ ਪ੍ਰਸੈਂਟ ਵਾਲੇ ਬੱਚੇ ਵੀ ਜਿਹੜੇ ਹੈਗੇ ਆ ਉਹ ਜ਼ਿਆਦਾਤਰ ਆਟਸ ਵਿੱਚ ਜਾਂਦੇ ਹਨ ਆਟਸ ਵਿੱਚ ਜਾਣ ਦਾ ਉਨ੍ਹਾਂ ਦਾ ਇਹ ਕਾਰਨ ਆ ਹੁਣ ਕਈ ਬੱਚੇ ਬਾਅਦ ਵਿੱਚ ਸਾਡੇ ਇੱਥੇ ਆਈ ਆਈ ਟੀਸ ਬਹੁਤ ਖੁੱਲ੍ਹੀਆਂ ਆਈ ਆਈ ਟੀ ਖੁੱਲ੍ਹੀ ਹੋਈ ਹੈ ਆਈ ਆਈ ਟੀ ਵਿੱਚ ਕੋਈ ਵੀ ਡਿਪਲੋਮਾ ਕਰ ਲੈਂਦੇ ਹਨ ਜਿੱਦਾਂ ਪਲੰਬਰ ਦਾ ਹੋ ਗਿਆ ਜੀ ਜਾਂ ਇਲੈਕਟ੍ਰੀਕਲ ਦਾ ਹੋ ਗਿਆ ਇਹ ਆ ਪਰ ਇਨ੍ਹਾਂ ਵਿੱਚੋਂ ਕਾਫੀ ਬੱਚੇ ਏਦਾਂ ਦੇ ਹੁੰਦੇ ਆ ਜਿਹੜੇ ਬੱਚੇ ਖੇਡਣ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਅੱਛ ਅੱਛੇ ਜਿਹੜੇ ਖੇਲਦਾ ਆ ਉਹ ਜਿੱਦਾਂ ਅੱਗੇ ਟਰਾਈ ਸਾਡੇ ਇੱਥੇ ਪੰਜਾਬ ਵਿੱਚ ਵਿੰਗ ਖੁੱਲ੍ਹੇ ਹੋਏ ਆ ਜਿੱਦਾਂ ਫੁੱਟਬਾਲ ਦੀਆਂ ਅਕੈਡਮੀਸ ਖੁੱਲ੍ਹੀਆਂ ਹੋਈਆਂ ਏ ਜਾਂ ਲਾ ਲਓ ਤੁਸੀਂ ਅਥਲੈਟਿਕਸ ਦੇ ਕੁਝ ਵਿੰਗ ਖੁੱਲ੍ਹੇ ਹੋਏ ਆ ਸਾਡੇ ਚੰਡੀਗੜ੍ਹ ਲਾਗੇ ਹੋਣ ਕਰਕੇ ਬੱਚੇ ਉੱਥੇ ਵੀ ਖੇਡ ਦੇ ਨਾਲ ਖੇਡ ਦੇ ਹਿਸਾਬ ਵਿੱਚ ਚਲੇ ਜਾਂਦੇ ਹਨ ਬਾਕੀ ਹੋਰ ਤਾਂ ਇਹ ਇਹੀ ਆ ਜਿਹੜੀਆਂ ਤਿੰਨ ਚਾਰ ਚੀਜ਼ਾਂ ਸਾਡੇ ਇੱਥੇ ਜਿਹੜੀਆਂ ਜ਼ਿਆਦਾ ਏ ਬਾਕੀ ਹੋਰ ਤਾਂ ਮੈਨੂੰ ਇੱਦਾਂ ਦਾ ਕੁਝ ਲੱਗਦਾ ਨਹੀਂ ਹਾਂ ਜਿਹੜੇ ਬੱਚੇ ਕੁਝ ਇੱਦਾਂ ਦੇ ਆ ਜਿਹੜੇ ਜਿਹੜੇ ਬੱਚੇ ਜ਼ਿਆਦਾ ਹੀ ਜ਼ਿਆਦਾ ਹੀ ਪੜ੍ਹਨੇ ਵਿੱਚ ਜਿਨ੍ਹਾਂ ਦੇ ਨਾਈਟੀ ਨਾਈਨ ਪ੍ਰਸੈਂਟ ਆਉਂਦੇ ਆ ਉਹ ਡੰਮੀ ਐਡਮੀਸ਼ਨ ਲੈ ਕੇ ਕਿਤੇ ਖੇਤਰ ਜਿੱਦਾਂ ਆਈ ਏ ਐੱਸ ਦੀ ਕੋਚਿੰਗ ਲਾ ਲਓ ਜਿੱਦਾਂ ਸਾਡੇ ਇੱਥੇ ਰੋਪੜ ਆਈ ਆਈ ਟੀ ਖੁੱਲ੍ਹੀ ਹੋਈ ਆ ਆਈ ਆਈ ਟੀ ਦੀ ਕੁਝ ਤਿਆਰੀ ਕਰਨ ਲੱਗੇ ਪੈਂਦੇ ਹਨ ਇੱਦਾਂ ਦੇ ਬੱਚੇ ਜਾਂ ਬੱਚੇ ਕੁਝ ਜ਼ਿਆਦਾ ਜਿਹੜਾ ਅੱਜ ਪੰਜਾਬ ਦਾ ਰੁਝਾਨ ਆ ਆਈਲੈਟਸ ਖੇਤਰ ਵਿੱਚ ਚਲੇ ਜਾਂਦੇ ਆ ਆਈਲੈਟਸ ਕਰਕੇ ਵੀ ਜਿੱਦਾਂ ਕਿਸੇ ਨੇ ਕੈਨੇਡਾ ਜਾਣਾ ਅਮਰੀਕਾ ਜਾਣਾ ਉਹ ਤਿਆਰੀ ਕਰ ਕਰਨ ਲੱਗ ਜਾਂਦੇ ਹਨ